ਮੈਂ ਅਤੇ ਮੇਰਾ ਪਰਿਵਾਰ ਕੱਲ ਸ਼ਾਮੀ ਪਾਰਟੀ 'ਤੇ ਜਾਣ ਲਈ ਤਿਆਰ ਹੋਏ ਅਤੇ ਅਸੀਂ ਠੀਕ ਨੌ ਵਜੇ ਪਾਰਟੀ ਉੱਪਰ ਪਹੁੰਚ ਗਏ ਪਰ ਉੱਧਰੋਂ ਪਾਰਟੀ ਬੜੀ ਲੇਟ ਸ਼ੁਰੂ ਹੁੰਦੀ ਹੈ ਪਾਰਟੀ ਸੀ ਰਾਮਪੁਰਾ ਫੂਲ ਵਿਖੇ ਰਾਮਪੁਰਾ ਫੂਲ ਜਦੋਂ ਅਸੀਂ ਪਹੁੰਚੇ ਤਾਂ ਉੱਥੇ ਅਜੇ ਮਹਿਮਾਨ ਬਹੁਤ ਘੱਟ ਆਏ ਸੀ ਪਰ ਮਹਿਮਾਨ ਘੱਟ ਆਉਣ ਕਰਕੇ ਪਾਰਟੀ ਲੇ ਦੇਰ ਨਾਲ ਸ਼ੁਰੂ ਹੋਈ ਅਤੇ ਅਸੀਂ ਰਾਤ ਨੂੰ ਐ ਦਸ ਵਜੇ ਵਾਪਸ ਘਰ ਆਉਣਾ ਸੀ ਪਰ ਸਾਡੇ ਕੋਲ ਆਪਣਾ ਸਾਧਨ ਨਹੀਂ ਸੀ ਇ ਇਸ ਲਈ ਅਸੀਂ ਕੈਬ ਕਰਵਾਈ ਕੈਬ ਉੱਪਰ ਅਸੀਂ ਆਪਣੀ ਫੈਮਿਲੀ ਦੇ ਨਾਲ ਸੁਰੱਖਿਅਤ ਢੰਗ ਨਾਲ ਘਰ ਪਹੁੰਚੇ ਕਿਉਂਕਿ ਕੈਬ ਰਾਤ ਦੇ ਸਮੇਂ ਸਾਡੇ ਕੋਲ ਪਹੁੰਚੀ ਅਤੇ ਉਹ ਅਸੀਂ ਆਪਦੇ ਘਰ ਘੁੱਦਾ ਵਿਖੇ ਆਉਣਾ ਸੀ ਘੁੱਦਾ ਜਦੋਂ ਪਹੁ ਘੁੱਦਾ ਜਦੋਂ ਆਉਂਦੇ ਹਾਂ ਬਠਿੰਡਾ ਵਿੱਚ ਦੀ ਤਾਂ ਬਹੁਤ ਸੁੰਨਸਾਨ ਏਰੀਆ ਅਤੇ ਜਿੱਥੋਂ ਸੁਰ ਅਕਸਰ ਲੁੱਟ ਖੋਹ ਦੀਆਂ ਜਿਹੜੀਆਂ ਖਬਰਾਂ ਉਹ ਮਿਲਦੀਆਂ ਰਹਿੰਦੀਆਂ ਅਤੇ ਅਸੀਂ ਉਸ ਕੈਬ ਵਾਲੇ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਐਂ ਜਿਨ੍ਹਾਂ ਨੇ ਸਾਨੂੰ ਪੂਰੇ ਸੁਰੱਖਿਅਤ ਢੰਗ ਨਾਲ ਆਪਣੇ ਘਰ ਪਹੁੰਚਾਇਆ